ਮੈਂ ਕਿਹਾ ਭਾਅ ਜੀ ਹੇਅਰ ਸਟਾਇਲਿੰਗ ਤੋਂ ਬੋਲਦੇ ਅੱਛਾ ਮੈਂ ਕਿਹਾ ਭਾਅ ਜੀ ਬਾਲ ਕਟਾਣੇ ਸੀਗੇ ਨਾਲੇ ਨਾਲੇ ਕੁੰਡਲਾ ਪਵਾ ਨਾਲੇ ਕੁੰਡਲਾ ਪਵਾਣੇ ਅੱਛਾ ਕਿਆ ਪੈਸੇ ਕਿੰਨੇ ਰੇਟ ਭਾਅ ਜੀ ਵਾਲ ਕੁੰਡਲੇ ਵੀ ਕਰਾਣੇ ਹੈ ਦਾੜ੍ਹੀ ਵੀ ਕਰਾਣੀ ਹੈ ਵਾਲ ਕਟਿੰਗ ਵੀ ਕਰਾਣੇ ਹੈ ਠੀਕ ਹੈ ਹਾਂ ਕੁੰਡਲੇ ਵੀ ਕਰਾਣੇ ਅੱਛਾ ਤਾਂ ਸੈਵਨ ਕਟਿੰਗ ਦੇ ਕਿੰਨੇ ਪੈਸੇ ਲਉਂਗੇ ਦਾੜ੍ਹੀ ਨਾਲੇ ਸੈਵਨ ਕਟਿੰਗ ਅੱਛਾ ਉਹਦੇ ਅਲੱਗ ਹੈਂ ਅੱਛਾ ਸਕਰੱਬ ਦਾ ਅੱਛਾ ਹੁਣ ਕਿੰਨੇ ਕੁ ਨੰਬਰ ਬੈਠੇ ਵੇ ਅੱਛਾ ਕਿੰਨਾਂ ਕੁ ਟਾਈਮ ਹੁੰਦਾ ਫਿਰ ਵੀ ਅੱਛਾ ਦੇਖ ਲਓ

ਜ਼ਰੂਰੀ ਹੈ ਭਾਅ ਜੀ ਤਾਂ ਹੀ ਫ਼ੋਨ ਕੀਤਾ ਮੈਂ ਭਾਅ ਜੀ ਮੈਂ ਚੰਡੀਗੜ੍ਹ ਨੂੰ ਜਾਣਾ ਹਾਂਜੀ ਭਾਅ ਜੀ ਵਿਆਹ ਹੈ ਅੱਛਾ ਚੱਲ ਹੈਂ ਨਹੀਂ ਨਹੀਂ ਤੁਸੀਂ ਕਰਿਓ ਭਾਅ ਜੀ ਫ਼ੋਨ ਨੰਬਰ ਤੁਹਾਡੇ ਕੋਲ ਬੈਠੇ ਵੇ ਮੇਰੇ ਕੋਲ ਮੈਂ ਥੋੜ੍ਹੀ ਮੈਂ ਤਾਂ ਤੁਹਾਡਾ ਕਸਟਮਰ ਹੈ ਮੂਹਰੇ ਮੈਂ ਤਾਂ ਤੁਹਾਨੂੰ ਪੁੱਛ ਰਿਹਾ ਮੈਂ ਕਿਆ ਭਾਅ ਜੀ ਯਾਰ ਕਿੰਨਾਂ ਕੁ ਟਾਇਮ ਲੱਗੂਗਾ

ਅੱਛਾ ਨਹੀਂ ਕਿੰਨੇ ਵਜੇ ਤੱਕਰ ਦੁਕਾਨ ਖੁੱਲ੍ਹੀ ਹੈ ਤੁਹਾਡੀ ਅੱਛਾ ਅੱਛਾ ਚੱਲ ਮੈਂ ਨਾ ਕੋਈ ਨਾ ਹਮ ਓਕੇ